ਕੈਲਸ਼ੀਅਮ ਦੀ ਕਮੀ ਦੇ ਨਾਲ ਗਾਵਾਂ ਵਿੱਚ ਕਲਾਮਟਿਕ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ ਮਿਲਕ ਫੀਵਰ ਹੋ ਜਾਂਦਾ ਹੈ ਜਿਸ ਨੂੰ ਹਾਈਮਨੋ ਕਲੇਮੀਆ ਵੀ ਕਿਹਾ ਜਾਂਦਾ ਹੈ ਗਾਂ ਨੂੰ ਕੈਲਸ਼ੀਅਮ ਦੀ ਕਮੀ ਨਾਲ ਇਹ ਬਿਮਾਰੀ ਹੋ ਜਾਂਦੀ ਹੈ ਇਹਦੇ ਨਾਲ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਹੈ ਗਰਭਵਤੀ ਮਾਂ ਦੁੱਧ ਦੇ ਉਤਪਾਦਨ ਵਿੱਚ ਘੱਟ ਹੋ ਜਾਂਦੀ ਹੈ ਇਹ ਗਰਭ ਵਸ ਅਵਸਥਾ ਦੇ ਦੌਰਾਨ ਇਹ ਬਿਮਾਰੀ ਗਾਵਾਂ ਨੂੰ ਹੋ ਜਾਂਦੀ ਹੈ ਜੋ ਗਾਂ ਤੰਦਰੁਸਤ ਹੁੰਦੀ ਹੈ ਉਸ ਦਾ ਦੁੱਧ ਬੜਾ ਪੌਸ਼ਟਿਕ ਹੁੰਦਾ ਹੈ ਇਸ ਵਿੱਚ ਗਾਂ ਦੀ ਤਵਚਾ ਖੰਡੀ ਹੋ ਜਾਂਦੀ ਹੈ ਗਾਂ ਆਲਸੀ ਹੋ ਜਾਂਦੀ ਹੈ ਉਹਦੀ ਮਾਸਪੇਸ਼ੀਆਂ ਵਿੱਚ ਕੰਬਣ ਜਾਂ ਜਕੜਨ ਦੀ ਸ਼ਿਕਾਇਤ ਹੋ ਜਾਂਦੀ ਹੈ ਇਸ ਲਈ ਗਾਂ ਨੂੰ ਇਹ ਬਿਮਾਰੀ ਲੱਗ ਜਾਂਦੀ ਹੈ ਧੰਨਵਾਦ